ਅੱਜ ਕੱਲ ਲੋਕ ਆਪਣੇ ਅਸਲੀ ਭਗਵਾਨਾਂ ਨੂੰ ਛੱਡ ਕੇ ਵਹਿਮਾਂ ਭਰਮਾਂ ਵਿੱਚ ਫਸੇ ਹੋਏ ਹਨ ਉਹ ਗੁਰੂਆਂ ਚੇਲਿਆਂ ਆਦੀਆਂ ਦੇ ਜਾਲ ਵਿੱਚ ਫਸ ਜਾਂਦੇ ਹਨ ਉਹਨਾਂ ਅੱਗੇ ਬਹੁਤ ਸਾਰਾ ਧਨ ਲੁਟਾ ਦਿੰਦੇ ਹਨ ਅੱਜ ਕੱਲ ਵਹਿਮ ਭਰਮ ਦੇ ਆਦਰਸ਼ ਸ਼ੀਲਤਾ ਡਰ ਹੈ ਇਹਨਾਂ ਦੇ ਕੁਝ ਸ਼ਗਨ ਵੀ ਮੰਨੇ ਜਾਂਦੇ ਹਨ ਅਤੇ ਅਪਸ਼ਗਨ ਵੀ ਮੰਨੇ ਜਾਂਦੇ ਹਨ ਅਪਸ਼ਗਨ ਜਿਵੇਂ ਕਿ ਕਿਸੇ ਕੰਮ ਨੂੰ ਜਾਣ ਲੱਗੇ ਜਾਂ ਸਲਾਹ ਕਰਨ ਲੱਗੇ ਕੁੱਤੇ ਦਾ ਕੰਨ ਮਾਰਨਾ ਕਿਸੇ ਦਾ ਕੰਮ ਨੂੰ ਤੁਰਨ ਲੱਗੇ ਛਿੱਕ ਮਾਰਨਾ ਘਰੋਂ ਨਿਕਲਦੇ ਵਿਅਕਤੀ ਨੂੰ ਖਾਲੀ ਟੋਕਰਾ ਜਾਂ ਖਾਲੀ ਘੜਾ ਮਿਲਣਾ ਘਰ ਤੋਂ ਤੁਰੇ ਵਿਅਕਤੀ ਨੂੰ ਪਿੱਛੋਂ ਹਾਕ ਮਾਰਨਾ ਬਿੱਲੀ ਜਾਂ ਕਾਲੇ ਹਿਰਨ ਦਾ ਰਾਹ ਕੱਟਣਾ ਰਾਤ ਨੂੰ ਕਿਸੇ ਚੰਗੇ ਕੰਮ ਬਾਰੇ ਸਲਾਹ ਕਰਨੀ ਕਿਸੇ ਸ਼ੁਭ ਕੰਮ ਨੂੰ ਜਾਂਦੇ ਹੋਏ ਰਸਤੇ ਵਿੱਚ ਬ੍ਰਾਹਮਣ ਜਾਂ ਨੰਬਰਦਾਰ ਦਾ ਮਿਲਣਾ ਜਾਂ ਮੱਥੇ ਲੱਗਣਾ ਮਾੜਾ ਸ਼ਗਨ ਸਮਝਿਆ ਜਾਂਦਾ ਹੈ ਚੌਥ ਦਾ ਚੰਨ ਮੱਥੇ ਲੱਗਣਾ ਮਾੜਾ ਸਮਝਿਆ ਜਾਂਦਾ ਹੈ ਇਹਨਾਂ ਦੇ ਕੁਝ ਸ਼ਗਨ ਵੀ ਮੰਨੇ ਜਾਂਦੇ ਹਨ ਜਿਵੇਂ ਕਿ ਸੱਪ ਅਤੇ ਨਿਊਲੇ ਦੀ ਲੜਾਈ ਦੇਖਣਾ ਕਿਸੇ ਕੰਮ ਨੂੰ ਜਾਣ ਲੱਗੇ ਚੂਹੜੇ ਦਾ ਮਿਲਣਾ ਕਿਸੇ ਕੰਮ ਜਾਣ ਲੱਗੇ ਰਸਤੇ ਵਿੱਚ ਪਾਣੀ ਦਾ ਘੜਾ ਜਾਂ ਹਰੇ ਚਾਰੇ ਦਾ ਮਿਲਣਾ ਸ਼ੁਭ ਮੰਨੇ ਜਾਂਦੇ ਹਨ ਤਿੱਤਰ ਦਾ ਦਿਖਣਾ ਜਾਂ ਬੋਲਣਾ ਘੁਮਿਆਰਾਂ ਦੇ ਗਧੇ ਦਾ ਉੱਚੀ ਉੱਚੀ ਹੀਂਗਣਾ ਇਸ ਤਰ੍ਹਾਂ ਨਵਾਂ ਦੂਜ ਜਾਂ ਤੀਜ ਦਾ ਚੰਨ ਦੇਖਣਾ ਵੀ ਸ਼ੁਭ ਮੰਨੇ ਜਾਂਦੇ ਹਨ ਲੋਕ ਭੂਤਾਂ ਪ੍ਰੇਤਾਂ ਬਾਰੇ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਸ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਉਹ ਭੂਤ ਬਣ ਜਾਂਦੇ ਹਨ ਕਮੌਤ ਮਰੇ ਬੰਦੇ ਦੀ ਜਿੰਨਾ ਚਿਰ ਪਹੋਏ ਦੇ ਤੀਰਥ 'ਤੇ ਗਤੀ ਨਹੀਂ ਹੁੰਦੀ ਉਹ ਭਟਕਦਾ ਰਹਿੰਦਾ ਹੈ ਜਿਹੜੀ ਜਨਾਨੀ ਸਿਲੇ ਵਿੱਚ ਕੁਚੀਲ ਮਰ ਜਾਂਦੀ ਹੈ ਉਹ ਚੂੜੇਲ ਬਣ ਜਾਂਦੀ ਹੈ ਬੱਚੇ ਦੇ ਜੰਮਣ ਵੇਲੇ ਮੰਜੇ ਹੇਠਾਂ ਦੰਦਲ ਦਾਤੀ ਲੋਹੇ ਦਾ ਜਿੰਦਾ ਮੰਤਰ ਪੜ੍ਹ ਕੇ ਪਾਣੀ ਦਾ ਕੁੱਜਾ ਰੱਖਿਆ ਜਾਂਦਾ ਹੈ ਅਤੇ ਨਾਲ ਹੀ ਠਿੱਕਰੇ ਵਿੱਚ ਧੁੱਖਦੇ ਗੋਹਿਆਂ ਵਾਲੀ ਗੁੱਗਲ ਦੀ ਧੂਣੀ ਲਈ ਅੱਗ ਮਘਾ ਦਿੱਤੀ ਜਾਂਦੀ ਆ ਇਸ ਕਰਨ ਨਾਲ ਮਾੜੀ ਚੀਜ਼ ਜਨਣੀ ਅਤੇ ਬੱਚੇ ਦੇ ਨਲੀ ਫੁਸ਼ਕ ਦੇ